ਪੰਜ ਜਨਵਰੀ ਉੱਨੀ ਸੌ ਅੱਸੀ ਉੱਨੀ ਦਸੰਬਰ ਦੋ ਹਜ਼ਾਰ ਪੰਜ ਛੱਬੀ ਜੁਲਾਈ ਦੋ ਹਜ਼ਾਰ ਬਾਰ੍ਹਾਂ ਅਠਾਰ੍ਹਾਂ ਅਗਸਤ ਦੋ ਹਜ਼ਾਰ ਸੋਲ੍ਹਾਂ ਉਣੱਤੀ ਮਈ ਦੋ ਹਜ਼ਾਰ ਤਿੰਨ